ਹੈਲੋ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਜੋ ਮੇਰੇ ਕੋਲ ਜੋ ਮਤਲਬ ਪੇਪਰ ਦੇ ਵਿੱਚ ਪੇਪਰ ਦੇ ਵਿੱਚ ਜੋ ਤੁਹਾਡੀ ਸੈਲਰੀ ਸ਼ੋ ਹੋਈ ਹੈਗੀ ਆ ਉਹ ਹੀ ਮਤਲਬ ਉਹਦੇ ਵੱਲੋਂ ਡਿਪਾਰਟਮੈਂਟ ਵੱਲੋਂ ਪਾਈ ਜਾ ਰਹੀ ਹੈ ਜੀ ਤੁਹਾਡੀ ਵੈਸੇ ਮਤਲਬ ਪ੍ਰਿੰਸੀਪਲ ਸਰ ਨਾਲ ਕਹਿੰਦੇ ਹੋ ਵੀ ਜ਼ਿਆਦਾ ਦੀ ਗੱਲ ਹੋਈ ਸੀ ਹੈ ਨਾ ਉਹ ਤਾਂ ਚੱਲੋ ਮੈਮ ਕੋਈ ਗੱਲ ਨਹੀਂ ਜੀ ਜਿਵੇਂ ਜਿਵੇਂ ਮਤਲਬ ਤੁਹਾਨੂੰ ਟਾਈਮ ਹੋਈ ਜਾਊਗਾ ਉਵੇਂ ਉਵੇਂ ਤੁਹਾਡੀ ਸੈਲਰੀ ਇਨਕਰੀਜ ਹੋਈ ਜਾਵੇਗੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਮੈਮ ਇਹ ਐਕਟੀਵਿਟੀਜ਼ ਤਾਂ ਤੁਹਾਡੇ ਮਤਲਬ ਪ੍ਰਮੋਸ਼ਨ ਲਈ ਵੀ ਬੈਸਟ ਹੈ ਮੈਮ ਜਿਵੇਂ ਤੁਸੀਂ ਐਕਟੀਵਿਟੀਜ਼ ਜਿਵੇਂ ਹੁਣ ਤੁਹਾਡੀ ਡਿਊਟੀ ਹਰੇਕ ਕੀਤੇ ਲਗਾ ਰਹੇ ਸਰ ਤਾਂ ਤੁਹਾਨੂੰ ਮਤਲਬ ਲਾਇਕ ਸਮਝਦੇ ਹੈਗੇ ਤਾਂ ਹੀ ਤੁਹਾਡੀ ਡਿਊਟੀ 'ਤੇ ਲਗਾ ਰਹੇ ਹੈਗੇ ਆ ਠੀਕ ਹੈ ਐਡਮਿਸ਼ਨ ਇਨਚਾਰਜ ਬਣਾਇਆ ਤੁਹਾਨੂੰ ਇਸ ਲਈ ਬਣਾਇਆ ਕਿ ਤੁਹਾਡੇ ਸਟੂਡੈਂਟਸ ਨਾਲ ਰਿਲੇਸ਼ਨ ਬਹੁਤ ਵਧੀਆ ਹੈਗੇ ਐਡਮਿਸ਼ਨ ਤੁਸੀਂ ਨਿਊ ਨਿਊ ਲੈ ਕੇ ਆਓਗੇ ਹੋਰ ਹੈ ਨਾ ਅਤੇ ਅੱਗੇ ਜਾ ਕੇ ਜਿਹੜੀ ਤੁਹਾਡੀ ਇਹ ਐਕਟੀਵਿਟੀ ਤੁਹਾਡੀ ਪ੍ਰਮੋਸ਼ਨ 'ਚ ਹੈਲਪ ਕਰਨਗੇ ਹੈ ਨਾ ਬਾਕੀ ਜੋ ਤੁਹਾਡੀ ਸੈਲਰੀ ਦੀ ਗੱਲ ਹੈਗੀ ਚੱਲੋ ਕੋਈ ਗੱਲ ਨਹੀਂ ਡਿਸਕਸ ਕਰਦੇ ਹੈਗੇ ਆ ਟੀਮ ਨਾਲ ਕੀ ਤੁਹਾਡੀ ਗੱਲ ਹੋਈ ਸੀ ਹੈ ਨਾ ਸਰ ਨਾਲ ਕੀ ਨਹੀਂ ਗੱਲ ਹੋਈ ਸੀਗੀ ਤਾਂ ਉਹ ਡਿਸਕਸ ਕਰ ਲਾਂਗੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਉਹ ਅ ਅਸਿਸਟੈਂਟ ਦਾ ਵੀ ਮੈਮ ਦੇਖ ਲਾਂਗੇ ਜੀ ਕਿਵੇਂ ਤੁਹਾਨੂੰ ਜਿਵੇਂ ਅਸਿਸਟੈਂਟ ਦਾ ਵੀ ਤੁਹਾਡੇ ਨਾਲ ਕਰਵਾ ਦੇਣਾ ਹੈਗੇ ਕਿ ਤੁਹਾਡੇ ਨਾਲ ਇੱਕ ਅਸਿਸਟੈਂਟ ਹੋਵੇ ਇੱਕ ਵਰਕ ਲੋਡ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾ ਚੱਲੋ ਕੋਈ ਗੱਲ ਨਹੀਂ ਮੈਮ ਅਸਿਸਟੈਂਟ ਅਸੀਂ ਦੇ ਦਾਂਗੇ ਇੱਕ ਹਾਂਜੀ ਅਤੇ ਓਕੇ ਥੈਂਕ ਯੂ ਜੀ